ਮੈਂ ਤੁਹਾਡੇ ਕੋਲ ਆਨਲਾਈਨ ਸ਼ਾਪਿੰਗ ਖਰੀਦਦਾਰੀ ਕੀਤੀ ਸੀ ਜਿਸ ਤੋਂ ਤੁਹਾਨੂੰ ਮੈਨੂੰ ਤੁਹਾਡੇ ਤੋਂ ਬਹੁਤ ਵਧੀਆ ਸਮਰਥਨ ਮਿਲਿਆ ਜਿਸ ਨਾਲ ਮੈਨੂੰ ਵਧੀਆ ਕਿਸਮ ਦੇ ਕੁਆਲਿਟੀ ਦੇ ਕੱਪੜੇ ਉਹ ਟਾਈਮ 'ਤੇ ਡਿਲੀਵਰੀ ਮਿਲੀ ਇਸ ਲਈ ਮੈਂ ਤੁਹਾਡਾ ਦਿਲ ਸੇ ਦਿਲ ਨਾਲ ਧੰਨਵਾਦ ਕਰਨਾ ਚਾਹੁੰਦੀ ਹਾਂ